ਭਾਰਤ ਵਿੱਚ ਕਈ ਧਰਮ ਹਨ ਅਤੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਹਨ ਪਰ ਮੈਨੂੰ ਕੁਝ ਪੁਰਾਣੀ ਧਾਰਮਿਕ ਪਰੰਪਰਾਵਾਂ ਚੰਗੀਆਂ ਨਹੀਂ ਲੱਗਦੀਆਂ ਪਰ ਮੈਂ ਕਿਸੇ ਵੀ ਧਰਮ ਬਾਰੇ ਮਾੜਾ ਬੋਲਣਾ ਜਾਂ ਲਿਖਣਾ ਨਹੀਂ ਚਾਹੁੰਦੀ ਕਿਉਂਕਿ ਇਹ ਭਾਰਤ ਵਿੱਚ ਵਰਜਿਤ ਹਨ ਅਤੇ ਕਈ ਲੋਕ ਆਪਣੇ ਧਰਮਾਂ ਨੂੰ ਲੈ ਕੇ ਸੰਵੇਦਨਸ਼ੀਲ ਹਨ ਅਤੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ